ਮੈਂ ਪੰਜਾਬੀ ਫਿਲਮ ਬਹੁਤ ਦੇਖਦਾ ਹਾਂ ਜਿਸ ਵਿੱਚ ਗੁੱਗੂ ਗਿੱਲ ਦੀਆਂ ਜ਼ਿਆਦਾਤਰ ਫਿਲਮਾਂ ਮੈਂ ਤਕਰੀਬਨ ਸਾਰੀ ਜਿੰਨੀਆਂ ਵੀ ਹੁਣ ਤੱਕ ਬਣੀਆਂ ਉਹ ਸਾਰੀਆਂ ਦੇਖੀਆਂ ਹੋਈਆਂ ਦੇਖੀਆਂ ਕਿਉਂਕਿ ਉਹਨਾਂ ਦਾ ਡਾਇਲੋਗ ਹੀ ਅਲੱਗ ਹੁੰਦਾ ਫਿਲਮਾਂ 'ਚ ਅਤੇ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਅਤੇ ਇਹਨਾਂ ਨੇ ਫਿਲਮਾਂ ਅਸੀਂ ਪਰਿਵਾਰ 'ਚ ਬੈਠ ਕੇ ਸਾਰੇ ਜੀਅ ਦੇਖ ਸਕਦੇ ਹਾਂ ਅਤੇ ਇਹੋ ਜਿਹਾ ਕੋਈ ਅਸ਼ਲੀਲਤਾ ਨਹੀਂ ਫੈਲਾਈ ਗਈ ਕਿ ਕਿ ਅਸੀਂ ਪਰਿਵਾਰ ਤੋਂ ਬਿਨਾ ਦੇਖੀਏ ਇਹਦੇ ਵਿੱਚ ਸਾਨੂੰ ਕਈ ਚੀਜ਼ਾਂ ਫਿਲਮਾਂ ਨੌਲੇਜ ਬਾਰੇ ਦਿੱਤਾ ਜਾਂ ਦੱਸਿਆ ਜਾਂਦਾ ਕਿ ਆਪਣਾ ਸਾਨੂੰ ਕਈ ਵਾਰੀ ਹਿਸਟਰੀ ਦੇ ਵਿੱਚੋਂ ਹੁੰਦੀ ਹੈ ਕਿ ਪੁਰਾਣਾ ਇਤਿਹਾਸ ਕਿਸ ਤਰ੍ਹਾਂ ਦਾ ਸੀਗਾ ਅਤੇ ਉਨ੍ਹਾਂ ਦੇ ਡਾਇਲੋਗ ਸਾਨੂੰ ਮੈਨੂੰ ਬਹੁਤ ਵਧੀਆ ਲੱਗਦੇ ਹਨ ਅਤੇ ਇਹਨਾਂ 'ਚੋਂ ਪਸੰਦੀਦਾ ਗਾਇਕ ਮੇਰਾ ਹੈਗਾ ਬੱਬੂ ਮਾਨ ਕਿਉਂਕਿ ਉਹ ਬਹੁਤ ਵਧੀਆ ਗਾਉਂਦਾ ਹੈ ਅਤੇ ਉਹ ਪੰਜਾਬੀ ਪੰਜਾਬ ਬਾਰੇ ਜ਼ਿਆਦਾਤਰ ਗੱਲ ਕਰਦਾ ਹੈ ਅਤੇ ਪੰਜਾਬੀ ਇਤਿਹਾਸ ਬਾਰੇ ਸਾਨੂੰ ਦੱਸਦਾ ਹੈ ਕਿ ਸਾਡਾ ਪੰਜਾਬ ਕਿੱਥੋਂ ਨਿਕਲਿਆ ਕੀ ਇਹਦੀ ਹਿਸਟਰੀ ਹੈ ਅਤੇ ਇਹਦੇ ਗੀਤ ਬਹੁਤ ਵਧੀਆ ਅਤੇ ਇਹ ਪਰਿਵਾਰ ਵਿੱਚ ਬਹਿ ਕੇ ਅਸੀਂ ਸੁਣ ਸਕਦੇ ਹਾਂ ਅਤੇ ਤਾਂ ਜੋ ਕਿ ਅਸ ਅਸੀਂ ਪਰਿਵਾਰ ਤੋਂ ਅਲੱਗ ਨਹੀਂ ਦੇਖ ਸਕਦੇ ਬਹੁਤ ਵਧੀਆ ਗੀਤ ਆ ਤਾਂ ਸਾਡੀ ਫੈਮਿਲੀ ਇਕੱਠੀ ਬੈਠ ਕੇ ਸਾਡੀ ਗੀਤ ਸੁਣਦੀ ਹੈ ਅਤੇ ਇਹਦੇ ਬਾਰੇ ਸਾਨੂੰ ਬਹੁਤ ਵਧੀਆ ਸਾਡਾ ਪਸੰਦ ਪਸੰਦੀਦਾ ਗਾਇਕ ਹੈ